ਭਾਰਤ ਦੀ ਸਰਕਾਰੀ ਭਾਸ਼ਾ ਜਿਹੜੀ ਉਹ ਹਿੰਦੀ ਆ ਦੇਸ਼ ਵਿੱਚ ਕੁਝ ਹੋਰ ਆਮ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹੁੰਦੀਆਂ ਨੇ ਜਿਵੇਂ ਪੰਜਾਬੀ ਹੋ ਗਈ ਅੰਗਰੇਜ਼ੀ ਹੋ ਗਈ ਹਿੰਦੀ ਹੋ ਗਈ ਤਾਮਿਲ ਹੋ ਗਈ ਮਰਾਠੀ ਹੋ ਗਈ ਗੁਜਰਾਤੀ ਹੋ ਗਈ ਸੰਸਕ੍ਰਿਤ ਹੋ ਗਈ ਤੇਲਗੂ ਉੜਦੂ ਮਲਿਆਲਮ ਹੋ ਗਈ ਅਸਾਮੀ ਹੋ ਗਈ ਅਤੇ ਮਰਾਠੀ ਹੋ ਗਈ ਕਸ਼ਮੀਰੀ ਹੋ ਗਈ ਉੜੀਸਾ ਡੋਗਰੀ ਨੇਪਾਲੀ ਹੋ ਗਈ ਸਿੰਧੀ ਹੋ ਗਈ ਮਨੀਪੁਰੀ ਹੋ ਗਈ ਅਤੇ ਦੇਸ਼ ਦੀਆਂ ਭਾਸ਼ ਭਾਸ਼ਾਈ ਭਿੰਨਤਾਵਾਂ ਬਾਰੇ ਅਸੀਂ ਸੋਚਦੇ ਹਾਂ ਵੀ ਜਿਵੇਂ ਸਾਡੇ ਦੇਸ਼ ਵਿੱਚ ਅਲੱਗ ਅਲੱਗ ਭਿੰਨਤਾ ਵਾਲੇ ਲੋਕ ਪਾਏ ਜਾਂਦੇ ਨੇ ਜਿਵੇਂ ਨਸਲ ਦੇ ਅਧਾਰ 'ਤੇ ਜਾਤੀ ਦੇ ਆਧਾਰ 'ਤੇ ਰੰਗ ਦੇ ਆਧਾਰ 'ਤੇ ਹੈ ਨਾ ਅਤੇ ਉਹਨਾਂ ਦੀਆਂ ਭਾਸ਼ਾਵਾਂ ਨੇ ਜਿਹੜੀਆਂ ਮਦਰ ਬੋਲੀ ਉਹਨਾਂ ਦੀ ਮਾਂ ਬੋਲੀ ਆ ਜਿਹੜੀ ਉਹ ਵੀ ਭਾਸ਼ਾ ਦੇ ਆਧਾਰ 'ਤੇ ਅਲੱਗ ਅਲੱਗ ਹੀ ਆ ਹੈ ਨਾ ਭ ਜਿਵੇਂ ਸਾਡੇ ਪੰਜਾਬ ਦੇ ਵਿੱਚ ਆ ਉਹ ਪੰਜਾਬੀ ਬੋਲੀ ਆ ਜਿਹੜੀ ਉਹਨੂੰ ਮਾਂ ਬੋਲੀ ਕਿਹਾ ਜਾਂਦਾ ਅਤੇ ਐਵੀਂ ਬਾਹਰਲੇ ਦੇਸ਼ਾਂ ਵਿੱਚ ਜਿਵੇਂ ਜਿਵੇਂ ਅੰਗਰੇਜ਼ੀ ਚੱਲਦੀ ਆ ਹੁਣ ਜਿਵੇਂ ਸਾਡੇ ਪੰਜਾਬ ਦੇ ਬੱਚੇ ਨੇ ਉਹ ਬਾਹਰਲੇ ਦੇਸ਼ਾਂ 'ਚ ਜਾਂਦੇ ਨੇ ਤਾਂ ਇੱਥੋਂ ਪੰਜਾਬ ਤੋਂ ਅੰਗਰੇਜ਼ੀ ਸਿੱਖ ਕੇ ਜਾਂਦੇ ਨੇ ਤਾਂ ਜੋ ਉਹਨਾਂ ਨੂੰ ਬੋਲਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਉਹਨਾਂ ਨਾਲ ਗੱਲਬਾਤ ਕਰਨ ਦੇ ਸਮੇਂ ਕੋਈ ਵੀ ਦਿੱਕਤ ਪੇਸ਼ ਨਾ ਆਵੇ ਇਸ ਕਰਕੇ ਹੁਣ ਸਾਡੇ ਬੱਚਿਆਂ ਨੂੰ ਪੰਜਾਬੀ ਵੀ ਆਉਂਦੀ ਆ ਹਿੰਦੀ ਵੀ ਆਉਂਦੀ ਆ ਵੀ ਉੱਥੇ ਜਾ ਕੇ ਉਹਨਾਂ ਨੂੰ ਹੋਰ ਵੀ ਅਲੱਗ ਅਲੱਗ ਭਾਸ਼ਾਵਾਂ ਨੇ ਜਿਹੜੀਆਂ ਉਹ ਸਿੱਖ ਜਾਂਦੇ ਨੇ ਅਤੇ ਐਨੀਆਂ ਭਾਰਤ ਵਿੱਚ ਐਨੀਆਂ ਭਾਸ਼ਾਵਾਂ ਹੋਣ ਦੇ ਨਾਤੇ ਸਾਰੇ ਲੋਕ ਆਪਣੇ ਸਾਰੇ ਧਰਮਾਂ ਨੂੰ ਜਿਹੜੀ ਇਕੱਠੇ ਹੋ ਕੇ ਨੇ ਜਿਹੜੇ ਮਨਾਉਂਦੇ ਨੇ ਅਤੇ ਖੁਸ਼ੀ ਖੁਸ਼ੀ ਇਹ ਸਾਰੀਆਂ ਚੀਜ਼ਾਂ ਨੂੰ ਉਹ ਇੰਜੋਏ ਵੀ ਕਰਦੇ ਨੇ